ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਹਾਂਜੀ ਭਾਅ ਜੀ ਹਰਪ੍ਰੀਤ ਟੂਰੰਰ ਐਂਡ ਟਰੈਵਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਹਾਂ ਹਾਂਜੀ ਹਾਂਜੀ ਭਾਅ ਜੀ ਹਾਂਜੀ ਹਾਂਜੀ ਭਾਅ ਜੀ

ਮੈਂ ਭਾਅ ਜੀ ਯਾਰ ਜਿੱਦਾਂ ਜਿਹੜਾ ਹੈਗਾ ਅਨੰਦਪੁਰ ਦਾ ਹੋਲਾ ਹੈ ਨਾ ਉਹ ਪੂਰੇ ਵਰਲਡ ਫੇਮਸ ਹੋਲਾ ਹੈ ਉੱਥੇ ਜਿੱਦਾਂ ਲੋਕ ਦੇਖੋ ਬਾਕੀ ਖੇਡਦੇ ਹੋਲੀਆਂ ਖਾਲਸਾ ਖੇਡੇ ਹੋਲਾ ਹਨਾ ਇਹ ਇਹ ਹੈਗਾ ਸਿੱਖ ਇਹ ਹੈਗਾ ਸਿੱਖੀ ਇਤਿਹਾਸ ਦਾ ਬਹੁਤ ਇਹਨਾਂ ਦਾ ਵੀ ਸਿੱਖਾਂ ਦਾ ਸਭ ਸੇ ਮੇਨ ਇਹ ਅੰਗ ਹੈ ਹੋਲੇ 'ਚ ਇਹ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਹੋਲਾ ਇਸ ਲਈ ਸ਼ੁਰੂ ਕੀਤਾ ਤਾ ਕਿ ਜਿਹੜੇ ਹੈਗੇ ਨਿਹੰਗ ਸਿੱਖਾਂ ਨੇ ਨਾ ਮਾਨਸਿਕ ਦੇ ਨਾਲ ਨਾਲ ਸਰੀਰਕ ਤੌਰ 'ਤੇ ਵੀ ਉਹ ਮਜ਼ਬੂਤ ਰਹਿਣ ਲੋਕ ਖੂਨ ਇਹ ਇਸ ਕਰਕੇ ਨਾ ਇਹਨਾਂ ਨੇ ਇੱਥੇ ਜਿਹੜੇ ਹੋਲਾ ਹੁੰਦਾ ਮ ਜਿਹੜੇ ਇਹ ਇੱਕ ਨਾ ਸਟੇਡੀਅਮ ਹੈ ਇੱਥੇ ਚਰਨਜੀਤ ਸਿੰਘ ਸਟੇਡੀਅਮ ਉੱਥੇ ਹੋਲਾ ਮਨਾਇਆ ਜਾਂਦਾ ਉੱਥੇ ਹੋਲੇ 'ਚ ਉੱਥੇ ਘੋੜ ਸਵਾਰੀਆਂ ਕੁਸ਼ਤੀਆਂ ਇਹਨਾਂ ਦੀਆਂ ਬਹੁਤ ਹਾਂਜੀ ਹਾਂਜੀ ਬਹੁਤ ਮੁੰਤਰਾ ਹਾਂ ਹਾਂਜੀ ਤੰਬੂ ਤੰਬੂ ਤੰਬੂ ਗੱਡਦੇ ਆ ਹਾਂਜੀ ਕੁ ਹਾਂਜੀ ਹਾਂਜੀ ਕੋਪਟੀਸ਼ਨ ਹੁੰਦੇ ਉੱਥੇ ਬਹੁਤ ਸਾਰੇ ਉੱਥੇ ਬਹੁਤ ਸਾਰੇ ਉੱਥੇ ਮੇਲੇ ਮੇਲਾ ਹੁੰਦਾ ਉੱਥੇ ਬਹੁਤ ਮ ਮਨੋਰੰਜਨ ਵਾਲੇ ਖੇਡਾਂ ਹੁੰਦੀਆਂ ਉੱਥੇ ਇਸ ਕਰਕੇ ਉੱਥੇ ਲੋਏ ਇਹ ਹੋਲਾ ਪੂਰੇ ਵਰਲਡ ਫੇਮਸ ਹੋਲਾ ਹੈ ਇਸ ਕਰਕੇ ਇਹਨੂੰ ਸਾਰੀ ਦੁਨੀਆ ਦੇਖਣ ਆਉਂਦੀ ਹੈ ਪੰਜਾਬ ਦੀ ਤਾਂ ਸਦਾ ਆਉਂਦੀ ਆਉਂਦੀ ਹੈ ਹਾਂਜੀ ਹਾਂਜੀ ਇਹ ਹਾਂਜੀ ਹਾਂਜੀ ਇਹ ਬਹੁਤ ਵਧੀਆ ਮੌਕਾ ਕਿਸੇ ਕਿਸੇ ਨੂੰ ਹੀ ਮੌਕਾ ਮਿਲਦਾ ਇਹ ਵੀ ਇਹੋ ਜਿਹਾ ਮੌਕਾ ਮੇਲਾ ਦੇਖਣ ਦਾ ਸਾਲਾਂ ਸਾਲ ਬਾਅਦ ਕਿਤੇ ਜਾ ਕੇ ਮੌਕਾ ਮਿਲਦਾ ਇਹ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼ੁਰੂ ਕੀਤਾ ਤਾ ਮੇਲਾ ਇਹ ਇਹ ਹੋਲਾ ਮਹੱਲਾ ਬੜਾ ਇਤਿਹਾਸਿਕ ਹੋਲਾ ਮਹੱਲਾ ਹੈ

ਹਾਂਜੀ ਹਾਂਜੀ ਹਾਂਜੀ ਰੌਣਕ ਮੇਲਾ ਤਾਂ ਬਹੁਤ ਹੁੰਦਾ ਭਾਅ ਜੀ ਇੱਕ ਤਾਂ ਠੀਕ ਹੈ ਹਾਂ ਤੁਸੀਂ ਭਾਅ ਜੀ ਰੌਣਕ ਮੇਲਾ ਤਾਂ ਬਹੁਤ ਹੁੰਦਾ ਤੁਸੀਂ ਫੈਨ ਤੁਸੀਂ ਕਿੱਦਣ ਨੂੰ ਆਉਣਾ ਭਾਅ ਜੀ ਉੱਦਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਭਾਅ ਜੀ ਉਹ ਤਾਂ ਛੱਡ ਦੇਵਾਂਗੇ ਹਾਂਜੀ ਤੁਸੀਂ ਹੋਰ ਹੂਰ ਤਾਂ ਨਹੀਂ ਕੋਈ ਜਗ੍ਹਾ ਘੁੰਮਣੀ ਠੀਕ ਹੈ ਜੀ ਭਾਅ ਜੀ ਠੀਕ ਓਕੇ ਭਾਅ ਜੀ ਸਤਿ ਸ਼੍ਰੀ ਅਕਾਲ